ਵੈਸੇ ਤਾਂ ਸਾਡੇ ਖੇਤਰ ਵਿੱਚ ਕ ਖੇਡਾਂ ਨਾਲ ਸਬੰਧਿਤ ਹਿੰਸਾ ਦੇ ਨਾਲ ਕੋਈ ਵੀ ਖਾਸ ਕਾਨੂੰਨ ਨਹੀਂ ਲਾਗੂ ਕੀਤਾ ਗਿਆ ਪਰ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੂਰਨਾਮੈਂਟ ਹੁੰਦਾ ਹੈ

ਸਾਡੇ ਖੇਤ ਦੇ ਵਿੱਚ ਪੁਲਿਸ ਦਾ ਖਾਸ ਪਹਿਰਾ ਰਹਿੰਦਾ ਹੈ ਅਤੇ ਉਸ ਉਹਨਾਂ ਦੁਆਰਾ ਕਈ ਰੂਲ ਬਣਾਏ ਜਾਂਦੇ ਹਨ ਜਿਵੇਂ ਕਿ ਕੋਈ ਵੀ ਵਿਅਕਤੀ ਜ਼ਿਆਦਾ ਨਸ਼ਾ ਕਰਕੇ ਟੂਰਨਾਮੈਂਟ ਦੇ ਵਿੱਚ ਨਹੀਂ ਆ ਸਕਦਾ ਅਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹਥਿਆਰ ਨਾਲ ਲਿਆ ਕੇ ਨਹੀਂ ਆ ਸਕਦਾ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਜਾਂ ਤਾਂ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ ਜਾਂ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਦਾ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਵੀ ਕਿਸੇ ਵੀ ਖਿਡਾਰੀ ਨੂੰ ਮਾੜਾ ਬੋਲਦਾ ਹੈ ਜਾਂ ਫਿਰ ਉਸ ਨਾਲ ਕੋਈ ਵੀ ਛੇੜਖਾਨੀ ਕਰਦਾ ਹੈ ਤਾਂ ਉਸ ਉੱਪਰ ਵੀ ਜੁਰਮਾਨਾ ਅਤੇ ਕਾਰਵਾਈ ਕੀਤੀ ਜਾਂਦੀ ਹੈ